ਬਿਮਾਰੀਆਂ ਤੋਂ ਬਚਣ ਲਈ ਅਸੀਂ ਆਪਣੀ ਸਿਹਤ ਦਾ ਚੰਗੀ ਤਰ੍ਹਾਂ ਖਿਆਲ ਰੱਖਦੇ ਹਾਂ ਜਿਵੇਂ ਕਿ ਅਸੀਂ ਬਾਹਰ ਦਾ ਭੋਜਨ ਫਾਸਟ ਫੂਡ ਵਗੈਰਾ ਪਸੰਦ ਨਹੀਂ ਕਰਦੇ ਅਸੀਂ ਭੋਜਨ ਵਗੈਰਾ ਆਪਣੇ ਘਰ ਹੀ ਬਣਾ ਕੇ ਖਾਂਦੇ ਹਾਂ ਅਤੇ ਦੂਸਰਾ ਸਵੇਰੇ ਅਸੀਂ ਉੱਠ ਕੇ ਸੈਰ ਵਗੈਰਾ ਕਰਦੇ ਹਾਂ ਸ਼ਾਮ ਨੂੰ ਵੀ ਸੈਰ ਕਰਦੇ ਹਾਂ ਇਸ ਕਰਕੇ ਸਾਡਾ ਸਰੀਰ ਬਿਮਾਰੀਆਂ ਤੋਂ ਬਚ ਸਕੇ ਅਤੇ ਸਾਡਾ ਸਰੀਰ ਸਿਹਤਮੰਦ ਰਹੇ ਇਸ ਕਰਕੇ ਇਹ ਚੀਜ਼ਾਂ ਜ਼ਰੂਰੀ ਹਨ ਤਾਂ ਜੋ ਕਿ ਅਸੀਂ ਸਿਹਤਮੰਦ ਰਹੀਏ ਅਤੇ ਬਾਹਰ ਦਾ ਭੋਜਨ ਨਹੀਂ ਖਾਣਾ ਚਾਹੀਦਾ ਹਮੇਸ਼ਾ ਭੋਜਨ ਆਪਣੇ ਘਰ ਹੀ ਬਣਾ ਕੇ ਤਾਜ਼ਾ ਅਤੇ ਫਰੈਸ਼ ਖਾਣਾ ਚਾਹੀਦਾ ਹੈ